ਮੇਰਾ ਨਾਮ ਰਾਕੇਸ਼ ਹੈ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਅਤੇ ਜੇ ਮੈਂ ਗੱਲ ਕਰਾਂ ਤਾਂ ਮੇਰੇ ਖਿਆਲ ਵਿੱਚ ਪੰਜਾਬੀ ਭਾਸ਼ਾ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਸੱਭਿਆਚਾਰਕ ਵਟਾਂਦਰੇ ਅਤੇ ਸੰਚਾਰ ਵਿੱਚ ਬਹੁਤ ਜ਼ਿਆਦਾ ਭੂਮਿਕਾ ਨਿਭਾਉਂਦੀ ਹੈ ਇਹ ਭਾਸ਼ਾ ਭਾਰਤੀ ਸੱਭਿਆਚਾਰ ਅਤੇ ਰਾਜਨੀਤਿਕ ਸਮਝੌਤੇ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਇਸ ਨੂੰ ਸ਼੍ਰੇਣੀਬੱਧ ਸਮਾਜ ਵਿੱਚ ਵਧੇਰੇ ਪ੍ਰਮੁੱਖ ਭਾਸ਼ਾ ਦੀ ਭੂਮਿਕਾ ਦਿੱਤੀ ਜਾਂਦੀ ਹੈ ਇਹ ਭਾਸ਼ਾ ਦੀ ਮਨਸ਼ਾ ਅਤੇ ਸੰਵੇਦਨਾਵਾਂ ਨੂੰ ਸਵੀਆਂ ਜਗਤਾਂ ਅਤੇ ਸਮਰੱਥਕਤਾ ਨਾਲ ਵਿਵਸਥਿਤ ਕਰਨ ਵਿੱਚ ਸਹਾਇਕ ਹੁੰਦੀ ਹੈ ਇਹ ਭਾਸ਼ਾ ਹਰ ਕਿਸਮ ਦੇ ਸੱਭਿਆਚਾਰ ਲਈ ਵਰਤੀ ਜਾਂਦੀ ਹੈ ਕਿਉਂਕਿ ਵਿਭਾਗੀ ਅਤੇ ਕਲਤਰਾਂ ਵਿੱਚ ਬੋਲੀ ਜਾਂਦੀ ਹੈ ਜਿਸ ਵਿੱਚ ਸਮਾਜਿਕ ਸੰਪੂਰਨਤਾ ਦਿੱਤੀ ਹੁੰਦੀ ਹੈ ਅਤੇ ਇਸ ਵਿੱਚ ਅਕਾਦਮੀ ਅਤੇ ਸਿਆਸੀ ਲਿਖਤਾਂ ਦੇ ਵਿਕਾਸ ਨੂੰ ਪ੍ਰੋਤਸਾਹਿਤ ਕੀਤਾ ਜਾਂਦਾ ਹੈ ਸਿਆਸੀ ਲਿਖਤਾਂ ਦੇ ਵਿਕਾਸ ਨੂੰ ਪ੍ਰੋਤਸਾਹਿਤ ਕੀਤਾ ਜਾਂਦਾ ਹੈ ਅਤੇ ਇਸ ਦੇ ਉਚਿਤ ਉਪਯੋਗ ਅਤੇ ਉਤਾਰ ਚੜਾਵ ਕੀਤਾ ਜਾਂਦਾ ਹੈ ਤਾਂ ਕਿ ਭਾਸ਼ਾ ਦੇ ਵਿਕਾਸ ਧਮਕ ਸੀਦ ਵਧਾਈ ਜਾ ਸਕੇ ਭਾਸ਼ਾ ਦਾ ਉਪਯੋਗ ਸਮਾਜ ਦੇ ਸਾਂਝੇ ਮੁੱਲਾਂ ਅਤੇ ਸੱਭਿਆਚਾਰ ਦੇ ਸਰੋਤਾਂ ਦੇ ਪੱਧਰ ਦਾ ਸਰੋਤ ਬਣਦਾ ਹੈ ਜਿਸ ਨਾਲ ਭਾਸ਼ਾ ਸਬੰਧੀ ਸੰਕਲਪ ਅਤੇ ਵਿਸ਼ੇਸ਼ਤਾਵਾਂ ਨੂੰ ਜ਼ਿਆਦਾ ਅਧਿਕ ਵਿਕਸਿਤ ਕੀਤਾ ਜਾ ਸਕਦਾ ਹੈ ਭਾਸ਼ਾ ਦੇ ਸ਼ਾਨਦਾਰਤਾ ਅਤੇ ਸੰਬੰਧ ਸੰਪਰਕਤਾ ਸਹਾਇਕ ਹੁੰਦੀ ਹੈ ਜਦੋਂ ਸੰਪੂ ਸਮੂਹਿਕ ਸੰਯੋਗ ਅਤੇ ਸਮਝੌਤੇ ਦੀ ਪਰੀਪੀ ਪਛ ਵਿੱਚ ਇਸ ਨੂੰ ਹੱਲ ਕਰਨ ਲਈ ਵਰਤਿਆ ਜਾਂਦਾ ਹੈ ਅੰਤ ਵਿੱਚ ਇਸ ਨੂੰ ਹੱਲ ਕਰਨ ਲਈ ਵਰਤਿਆ ਜਾਂਦਾ ਹੈ ਅੰਤ ਵਿੱਚ ਭਾਸ਼ਾ ਭਾਰਤ ਦੇ ਸਭ ਹਿੱਸਿਆਂ ਵਿੱਚ ਇੱਕ ਮਿਆਰ ਦਾ ਸਾਧਨ ਹੈ ਜੋ ਲੋਕਾਂ ਨੂੰ ਇੱਕ ਜੋੜ ਵਿੱਚ ਰੱਖਦਾ ਹੈ ਅਤੇ ਇਹਨਾਂ ਨੂੰ ਇੱਕ ਅਜਿਹੀ ਪਹਿਚਾਣ ਅਤੇ ਸਮਝ ਪ੍ਰਦਾਨ ਕਰਦਾ ਹੈ ਜੋ ਇਹਨਾਂ ਦੀਆਂ ਭਾਸ਼ਾਵਾਂ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਸਾਂਝਾ ਕਰਦੀ ਹੈ ਸਾਡੀ ਮਾਂ ਬੋਲੀ ਪੰਜਾਬੀ